ਪੰਜਾਬੀ ਭਾਸ਼ਾ ਬਹੁਤ ਹੀ ਮਿੱਠੀ ਅਤੇ ਸਰਲ ਭਾਸ਼ਾ ਹੈ ਇਹ ਹਰ ਇੱਕ ਬੰਦੇ ਨੂੰ ਅਸਾਨੀ ਨਾਲ਼ ਸਮਝ ਆ ਜਾਂਦੀ ਹੈ ਪਰ ਪੰਜਾਬੀ ਭਾਸ਼ਾ ਨੇ ਪੰਜਾਬੀ ਲੋਕਾਂ ਦੀ ਪਛਾਣ ਪੰਜਾਬ ਵਿੱਚ ਹੀ ਨਹੀਂ ਪੂਰੇ ਦੇਸ਼ ਵਿੱਚ ਬਣਾਈ ਹੈ ਕਿਉਂਕਿ ਹਰ ਇੱਕ ਬੰਦੇ ਨੂੰ ਪੰਜਾਬੀ ਬੋਲ ਬੋਲੀ ਸਿੱਖਣਾ ਸੁਣਨਾ ਪਸੰਦ ਹੈ ਪੰਜਾਬੀ ਭਾਸ਼ਾ ਨੇ ਪੰਜਾਬ ਦੀ ਸੱਭਿਅਤਾ ਅਤੇ ਇਤਿਹਾਸ ਨੂੰ ਬੜੀ ਡੂੰਘਾਈ ਨਾਲ਼ ਪ੍ਰਭਾਵਿਤ ਕੀਤਾ ਹੈ ਪੰਜਾਬੀ ਸੱਭਿਅਤਾ ਦੇ ਲੋਕ ਗੀਤ ਹਰ ਇੱਕ ਨੂੰ ਪਸੰਦ ਹਨ ਰਵਾਇਤੀ ਪਹਿਰਾਵਾ ਪੰਜਾਬੀ ਲੋਕ ਗੀਤ ਅਤੇ ਲੋਕ ਨਾਚ ਅਤੇ ਇਤਿਹਾਸ ਨੇ ਪੰਜਾਬੀਆਂ ਦੀ ਪਹਿਚਾਣ ਅਤੇ ਸੱਭਿਆਚਾਰ ਨੂੰ ਬੜੀ ਹੀ ਸੁਚੱਜੇ ਢੰਗ ਨਾਲ਼ ਪੂਰੇ ਸੰਸਾਰ ਵਿੱਚ ਦਰਸਾਇਆ ਹੈ